ਸਾਡੇ ਪੰਜਾਬ ਵਿੱਚ ਕਈ ਤਰ੍ਹਾਂ ਦੇ ਸੱਭਿਆਚਾਰਕ ਮੇਲੇ ਅਤੇ ਤਿਉਹਾਰ ਮਨਾਏ ਜਾਂਦੇ ਹਨ ਇਹ ਸੱਭਿਆਚਾਰਕ ਤਿਉਹਾਰ ਪੰਜਾਬ ਦੀ ਸ਼ਾਨ ਹੈ ਪੰਜਾਬ ਵਿੱਚ ਲੋਹੜੀ ਹੋਲੀ ਵਿਸਾਖੀ ਆਦਿ ਕਈ ਤਰ੍ਹਾਂ ਦੇ ਸੱਭਿਆਚਾਰਕ ਮੇਲੇ ਮਨਾਏ ਜਾਂਦੇ ਹੈ ਜਿਵੇਂ ਲੋਹੜੀ ਪੰਜਾਬ ਦਾ ਇੱਕ ਸੱਭਿਆਚਾਰਕ ਮੇਲਾ ਹੈ ਇਹ ਤਿਉਹਾਰ ਜਿਸ ਘਰ ਵਿੱਚ ਮੁੰਡੇ ਦੇ ਜਨਮ ਹੋਣ 'ਤੇ ਉਸ ਦੀ ਪਹਿਲੀ ਲੋਹੜੀ ਵੱਜੋਂ ਵੀ ਉਸ ਘਰ ਵਿੱਚ ਮਨਾਇਆ ਜਾਂਦਾ ਹੈ ਜਿਸ ਘਰ ਵਿੱਚ ਨਵਾਂ ਵਿਆਹ ਹੁੰਦਾ ਹੈ ਉਸ ਘਰ ਵਿਚ ਵੀ ਇਹ ਤਿਉਹਾਰ ਮਨਾਇਆ ਜਾਂਦਾ ਹੈ ਲੋਹੜੀ ਦੀ ਰਾਤ ਨੂੰ ਲੋਕਾਂ ਵਿੱਚ ਅੱਗ ਬਾਲ ਕੇ ਲੋ ਲੋਹੜੀ ਮਨਾਈ ਜਾਂਦੀ ਹੈ ਇਸ ਤਰ੍ਹਾਂ ਪੰਜਾਬ ਵਿੱਚ ਵਿਸਾਖੀ ਤਿਉਹਾਰ ਵੀ ਇੱਕ ਬੜਾ ਵੱਡਾ ਸੱਭਿਆਚਾਰਕ ਤਿਉਹਾਰ ਹੈ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਵਿਖੇ ਇਹ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਵਿਸਾਖੀ ਦਾ ਸਬੰਧ ਸਿੱਖ ਧਰਮ ਦੇ ਨਾਲ ਵੀ ਹੈ ਇਸ ਦੀ ਸਾਡੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਇਸ ਦਿਨ ਆਨੰਦਪੁਰ ਸਾਹਿਬ ਵਿਖੇ ਉਸ ਦਿਨ ਦੀ ਯਾਦ ਵਿੱਚ ਬੜੀ ਧੂਮ ਧਾਮ ਨਾਲ ਮਨਾਉਂਦੇ ਹਨ ਇਸ ਦਿਨ ਆਨੰਦਪੁਰ ਵਿੱਚ ਗੱਤਕਾ ਘੋੜ ਸਵਾਰੀ ਆਦਿ ਕਈ ਤਰ੍ਹਾਂ ਦੇ ਕਰਤੱਵ ਦਿਖਾਏ ਜਾਂਦੇ ਹੈ ਵਿਸਾਖੀ ਦਾ ਸਬੰਧ ਸਾਡੀ ਫ਼ਸਲਾਂ ਦੇ ਨਾਲ ਵੀ ਹੈ ਵਿਸਾਖੀ ਵਾਲੇ ਦਿਨ ਕਿਸਾਨ ਆਪਣੀ ਕਣਕ ਦੀ ਫ਼ਸਲ ਤਿਆਰ ਹੋ ਜਾਣ ਦੀ ਖੁਸ਼ੀ ਵਿੱਚ ਇਸ ਦਿਨ ਨੂੰ ਖੁਸ਼ੀ ਨਾਲ ਮਨਾਉਂਦੇ ਹਨ ਅਤੇ ਇਸ ਦਿਨ ਉਹ ਆਪਣੀ ਫ਼ਸਲ ਦੀ ਵਾਢੀ ਵੀ ਸ਼ੁਰੂ ਕਰਦੇ ਹੈ ਇਸ ਤਰ੍ਹਾਂ ਇਹ ਸੱਭਿਆਚਾਰਕ ਤਿਉਹਾਰ ਸਾਡੇ ਪੰਜਾਬ ਦੀ ਆਣ ਅਤੇ ਸ਼ਾਨ ਦਾ ਪ੍ਰਤੀਕ ਹੈ ਅਤੇ ਇਹ ਸਾਡੀ ਭਾਈਚਾਰੇ ਦੀ ਸਾਂਝ ਦਾ ਵੀ ਪ੍ਰਤੀਕ ਹੈ